ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਮੁੱਖ ਨਾਚ ਗਿੱਦਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦੋਂ ਕਿ ਗਿੱਧਾ ਮੁਟਿਆਰਾਂ ਦਾ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿਹਨਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ ਵਿਆਹ ਮੰਗਣੇ ਅਤੇ ਤਿਉਹਾਰ ਆਦਿ ਸ਼ਾਮਿਲ ਹਨ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ ਭੰਗੜਾ ਬਹੁਤ ਤਰ੍ਹਾਂ ਦਾ ਹੈ ਜਿਵੇਂ ਝੁੰਮਰ ਸੰਮੀ ਲੁੱਡੀ ਭੰਗੜਾ ਪੰਜਾਬੀਆਂ ਦਾ ਕੌਮੀ ਨਾਚ ਹੋਣ ਦਾ ਮਾਣ ਰੱਖਦਾ ਹੈ ਇਹ ਪੁਰਸ਼ਾਂ ਦਾ ਇੱਕੋ ਇੱਕ ਅਜਿਹਾ ਨਾਚ ਹੈ ਜਿਸ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੰਚ ਉੱਤੇ ਪੰਜਾਬ ਦੇ ਪੁਰਸ਼ਾਂ ਦੇ ਨਾਚ ਵਜੋਂ ਪ੍ਰਵਾਨ ਕੀਤਾ ਗਿਆ ਭੰਗੜੇ ਦੇ ਆਰੰਭ ਵਿੱਚ ਢੋਲੀ ਵਿਸ਼ੇਸ਼ ਕਿਸਮ ਦੀ ਤਾਲ ਨਾਲ ਭੰਗੜੇ ਵਾਲੇ ਗੱਭਰੂਆਂ ਨੂੰ ਸੱਦਦਾ ਹੈ ਬੋਲੀਆਂ ਬਿਨਾਂ ਭੰਗੜਾ ਅਧੂਰਾ ਸਮਝਿਆ ਜਾਂਦਾ ਹੈ ਭੰਗੜਾ ਅਜੇ ਪਹਿਲਾਂ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖਪੁਰੇ ਪੱਛਮੀ ਗੁਜਰਾਤ ਅਤੇ ਸਿਆਲਕੋਟ ਵਿੱਚ ਜ਼ਿਆਦਾ ਪ੍ਰਚਲਿਤ ਹੈ ਭੰਗੜੇ ਵਿੱਚ ਪੇਂਡੂ ਸਾਜ਼ਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਢੋਲ ਭੰਗੜੇ ਦਾ ਮੁੱਖ ਸਾਜ਼ ਹੈ ਭੰਗੜੇ ਵਿੱਚ ਢੋਲੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਭੰਗੜਾ ਪੰਜਾਬੀ ਨੌਜਵਾਨਾਂ ਦਾ ਮੁੱਖ ਨਾਚ ਪੰ ਲਗਭਗ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਪਾਇਆ ਜਾਂਦਾ ਹੈ ਜਿਹਨਾਂ ਵਿੱਚੋਂ ਵਿਸਾਖੀ ਦਾ ਮੇਲਾ ਪ੍ਰਮੁੱਖ ਹੈ ਜਦੋਂ ਕਿ ਕਿਸਾਨ ਆਪਣੀ ਫਸਲ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਤਾਂ ਉਹ ਭੰਗੜਾ ਪਾਉਂਦੇ ਹਨ ਭੰਗੜਾ ਤਾਕਤ ਹਿੰਮਤ ਬਹਾਦਰੀ ਅਤੇ ਜੋਸ਼ ਨਾਲ ਭਰਪੂਰ ਨਾਚ ਹੈ ਢੋਲ ਇਸ ਨਾਚ ਦਾ ਮੁੱਖ ਸਾਜ਼ ਹੈ ਸੰਮੀ ਪੱਛਮੀ ਪੰਜਾਬ ਦੇ ਬਾਹਰ ਦੇ ਇਲਾਕੇ ਦੀਆਂ ਔਰਤਾਂ ਦਾ ਨਾਚ ਹੈ ਇਸ ਨਾਚ ਦਾ ਨਾਂ ਸੰਮੀ ਨਾਮ ਨਾਲ ਕੁੜੀ ਉੱਪਰ ਪਾਇਆ ਗਿਆ ਹੈ ਇਸ ਵਿੱਚ ਕੁਛ ਔਰਤਾਂ ਘੇਰੇ ਘੇਰੇ ਵਿੱਚ ਖੋਲ੍ਹ ਕੇ ਉੱਪਰ ਵੱਲ ਬਾਂਹ ਕਰਕੇ ਸੁਰੀਲੀ ਆਵਾਜ਼ਾਂ ਵਿੱਚ ਗੀਤ ਗਾਉਂਦੀਆਂ ਹਨ ਇਸ ਵਿੱਚ ਪੈਰਾਂ ਦੀ ਧਮਕ ਨਾਲ ਤਾਲ ਹੱਥਾਂ ਦੀ ਤਾੜੀਆਂ ਅਤੇ ਉਂਗਲਾਂ ਨਾਲ ਚੁਟਕੀਆਂ ਵਜਾਉਂਦੀਆਂ ਹਨ ਇਹ ਨਾਚ ਬਾਹਾਂ ਦੇ ਹੁਲਾਰਿਆਂ ਉੱਤੇ ਆਧਾਰਿਤ ਹੈ ਲੁੱਡੀ ਲੁੱਡੀ ਪਾਉਣ ਪੰਜਾਬ ਵਿੱਚ ਪ੍ਰਚਲਿਤ ਮੁਹਾਵਰਾ ਹੈ ਜਿਸ ਦਾ ਭਾਵ ਖੁਸ਼ੀ ਮਨਾਉਣਾ ਜਾਂ ਜਸ਼ਨ ਹੈ ਪੁਰਾਣੇ ਸਮੇਂ ਵਿੱਚ ਜਦੋਂ ਫੌਜ ਜੰਗ ਜਿੱਤ ਕੇ ਮੁੜਦੀ ਸੀ ਤਾਂ ਲੁੱਡੀ ਪਾ ਕੇ ਜਵਾਨਾਂ ਦਾ ਸਵਾਗਤ ਕੀਤਾ ਜਾਂਦਾ ਸੀ ਸੰਮੀ ਅਤੇ ਲੁੱਡੀ ਵਿੱਚ ਸਿਰਫ ਇਤਨਾ ਹੀ ਫਰਕ ਹੈ ਕਿ ਸੰਮੀ ਵਿੱਚ ਨਾਚ ਦੇ ਨਾਲ ਨਾਲ ਗੀਤ ਗਾਇਆ ਜਾਂਦਾ ਹੈ ਜਦੋਂ ਕਿ ਲੁੱਡੀ ਦੇ ਨੱਚਣ ਸਮੇਂ ਅਜਿਹੀ ਕੋਈ ਵਿਵਸਥਾ ਨਹੀਂ ਹੈ ਝੁੰਮਰ ਆਮ ਤੌਰ 'ਤੇ ਮਰਦਾਂ ਦਾ ਨਾਚ ਹੈ ਪਰ ਕੁਝ ਥਾਵਾਂ 'ਤੇ ਔਰਤਾਂ ਵੀ ਝੁੰਮਰ ਪਾਉਂਦੀਆਂ ਹਨ ਇਸ ਨੂੰ ਬਲੋਚਨਾ ਦਾ ਨਾਚ ਵੀ ਕਹਿੰਦੇ ਹਨ ਇਸ ਵਿੱਚ ਨੱਚਣ ਵਾਲੇ ਝੂਮਦੇ ਹਨ ਜਿਸ ਕਰਕੇ ਇਸ ਨੂੰ ਝੁੰਮਰ ਕਿਹਾ ਜਾਂਦਾ ਹੈ ਇਸ ਲਈ ਵਿਸ਼ੇਸ਼ ਸਾਜ਼ ਢੋਲ ਹੈ ਇਸ ਵਿੱਚ ਨੱਚਣ ਵਾਲੇ ਗੱਭਰੂਆਂ ਢੋਲ ਦੁਆਲੇ ਗੋਲ ਚੱਕਰ ਕਰਕੇ ਬਾਹਾਂ ਉੱਪਰ ਕਰਕੇ ਖੜ੍ਹ ਜਾਂਦੇ ਹਨ ਫਿਰ ਤਾਲ ਵਿੱਚ ਖੱਬਾ ਪੈਰ ਅੱਗੇ ਅਤੇ ਪਿੱਛੇ ਰੱਖ ਕੇ ਬਾਹਾਂ ਨੂੰ ਹੁਲਾਰਾ ਦੇ ਕੇ ਹੱਥਾਂ ਨੂੰ ਹਿਲਾਉਂਦੇ ਹਨ